ਪੰਜਾਬ ਵਿੱਚ ਰਾਜ ਸਰਕਾਰ ਕਮਿਨਿਊਟੀ ਦੇ ਅੰਦਰ ਵੱਖ ਵੱਖ ਸਮੂਹਾਂ ਵਿਚਕਾਰ ਝਗੜਿਆਂ ਦਾ ਨਿਪਟਾਰਾ ਪ੍ਰਸ਼ਾਸਨ ਵੱਲੋਂ ਅਲੱਗ ਅਲੱਗ ਤਰੀਕਿਆਂ ਅਤੇ ਸੈਂਟਰਾਂ ਵੱਲੋਂ ਕੀਤਾ ਜਾਂਦਾ ਹੈ ਜਿਵੇਂ ਕਿ ਪਿੰਡਾਂ ਵਿੱਚ ਪ੍ਰਸ਼ਾਸਨ ਵੱਲੋਂ ਚੁਣੀ ਪੰਚਾਇਤ ਇਹਨਾਂ ਝਗੜਿਆਂ ਦਾ ਨਿਪਟਾਰਾ ਕਰਦੀ ਹੈ ਅਤੇ ਸਰਕਾਰ ਵੱਲੋਂ ਚੁਣੇ ਮਹਿਕਮਿਆਂ ਦੁਆਰਾ ਇਲਾਕਿਆਂ ਵਿੱਚ ਸਮਝੌਤਾ ਕੇਂਦਰ ਵੀ ਖੋਲ੍ਹੇ ਗਏ ਹਨ ਇੱਥੇ ਸਰਕਾਰ ਵੱਲੋਂ ਸੂਝਵਾਨ ਵਿਅਕਤੀਆਂ ਨੂੰ ਨਿਯੁਕਤ ਕੀਤਾ ਜਾਂਦਾ ਹੈ ਜੋ ਕਿ ਬੜੀ ਸਮਝ ਸਮਝਦਾਰੀ ਨਾਲ਼ ਦੋਹਾਂ ਧਿਰਾਂ ਵਿੱਚ ਸਮਝੌਤਾ ਕਰਵਾਉਂਦੀ ਹੈ